ਬਾਈਕ ਅੱਜ ਕੱਲ ਦੀ ਦੁਨੀਆ 'ਚ ਹਰ ਕਿਸੇ ਇਨਸਾਨ ਲਈ ਇੱਕ ਮਹੱਤਵਪੂਰਨ ਹਿੱਸਾ ਹੈ ਛੋਟਾ ਤਾਂ ਛੋਟਾ ਕੰਮ ਵੀ ਜੇ ਤੁਸੀਂ ਜਾਣਾ ਹੁੰਦਾ ਹੈ ਤਾਂ ਉਹ ਬਾਈਕ ਦੇ ਰਾਹੀ ਮਿੰਟਾਂ ਸਕਿੰਟਾਂ ਚ ਹੋ ਜਾਂਦਾ ਹੈ ਮੇਰੇ ਕੋਲ ਬੁਲਟ ਇਨ ਫੀਲਡ ਹੈ ਅਤੇ ਮੈਂ ਵੀ ਬੜਾ ਉਤਸਾਹਿਤ ਹੁੰਦਾ ਹਾਂ ਜਦੋਂ ਮੈਂ ਬੁਲਟ 'ਚ ਜਾਂ ਬਾਈਕ ਚ ਕਿਤੇ ਦੂਰ ਜਾਂਦਾ ਹਾਂ ਦੂਰ ਜਾਣ ਲਈ ਫਿਰ ਮੈਂ ਆਪਣੀ ਪੂਰੀ ਤਿਆਰੀ ਕਰਕੇ ਜਾਂਦਾ ਹਾਂ ਜਿਵੇਂ ਕਿ ਲੇਹ ਲਦਾਖ ਜਾਣਾ ਹੋਵੇ ਤਾਂ ਉਹਦੇ ਲਈ ਮੈਨੂੰ ਬਹੁਤ ਉਤਸਾਹਿਤਾ ਰਹੇਗੀ ਕਿ ਕਦੋਂ ਮੈਂ ਉਥੇ ਜਾਵਾਂ ਅਤੇ ਉਸ ਲਈ ਤਿਆਰੀ ਵੀ ਬਹੁਤ ਕਰਨੀ ਪੈਂਦੀ ਹੈ ਤੁਹਾਡੇ ਕੋਲ ਸਾਰਾ ਕੁਝ ਹੋਣਾ ਚਾਹੀਦਾ ਹੈ ਉਹਦੇ ਵਿੱਚ ਤੁਹਾਡੇ ਕੋਲ ਮੈਡੀਕਲ ਕਿੱਟ ਵੈਦਰ ਦੇਖ ਕੇ ਸਾਰਾ ਕੁਝ ਕਰਕੇ ਹੀ ਜਾਣਾ ਪੈਂਦਾ ਹੈ ਤਾਂ ਕਿ ਰਸਤੇ ਚ ਕੋਈ ਮੁਸ਼ਕਿਲ ਨਾ ਆਵੇ